ਸਾਡੇ ਰਾਜ ਵਿੱਚ ਪੰਜਾਬੀ ਭਾਸ਼ਾ ਬਹੁਤ ਹੀ ਮਹੱਤਵਪੂਰਨ ਭੂਮਿਕਾ ਨਿਭਾਉਂਦੀ ਹੈ ਖਾਸ ਕਰਕੇ ਸਿੱਖਿਆ ਪ੍ਰਣਾਲੀ ਵਿੱਚ ਜਿਵੇਂ ਕਿ ਅਸੀਂ ਜਾਣਦੇ ਹਾਂ ਕਿ ਅਸੀਂ ਪੰਜਾਬ ਵਿੱਚ ਰਹਿੰਦੇ ਹਾਂ ਤਾਂ ਪੰਜਾਬੀ ਆਮ ਤੌਰ 'ਤੇ ਇੱਥੇ ਦੇ ਹਰ ਇਨਸਾਨ ਨੂੰ ਆਉਂਦੀ ਹੈ ਅਤੇ ਹਰ ਕੋਈ ਸਮਝ ਵੀ ਲੈਂਦਾ ਹੈ ਜੇਕਰ ਅਸੀਂ ਪੰਜਾਬ ਵਿੱਚ ਚੰਗੀ ਤਰ੍ਹਾਂ ਰਹਿਣਾ ਹੈ ਤਾਂ ਸਾਨੂੰ ਪੰਜਾਬੀ ਆਉਣੀ ਅਤੇ ਬੋਲਣੀ ਆਉਣੀ ਚਾਹੀਦੀ ਹੈ ਇਸ ਲਈ ਪੰਜਾਬੀ ਸਿੱਖਿਆ ਪ੍ਰਣਾਲੀ ਵਿੱਚ ਜਮਾਤਾਂ ਵਿੱਚ ਸ਼ੁਰੂ ਤੋਂ ਹੀ ਸਿਖਾਉਣੀ ਸ਼ੁਰੂ ਕਰ ਦਿੰਦੇ ਹਨ ਪੰਜਾਬੀ ਸਕੂਲਾਂ ਕਾਲਜਾਂ ਵਿੱਚ ਆਮ ਤੌਰ 'ਤੇ ਸਿਖਾਈ ਜਾਂਦੀ ਹੈ ਕਈ ਜਗ੍ਹਾ ਪੰਜਾਬ ਕਈ ਜਗ੍ਹਾ ਪੰਜਾਬੀ ਪੰਜਾਬ ਦੇ ਬਾਹਰ ਵੀ ਸਿਖਾਈ ਜਾਂਦੀ ਹੈ ਪਰ ਪੰਜਾਬ ਵਿੱਚ ਪੰਜਾਬੀ ਸਿਖਾਉਣੀ ਕੰਪਲਸਰੀ ਹੁੰਦੀ ਹੈ ਪੰਜਾਬ ਵਿੱਚ ਕਈ ਕਈ ਜਗ੍ਹਾਵਾਂ 'ਤੇ ਸਾਰੇ ਕੰਮ ਪੰਜਾਬੀ ਵਿੱਚ ਹੀ ਹੁੰਦੇ ਹਨ ਜਿਵੇਂ ਕਈ ਸਰਕਾਰੀ ਕੰਮ ਜਾਂ ਕਈ ਪ੍ਰਾਈਵੇਟ ਕੰਮ ਵੀ ਪੰਜਾਬੀ ਵਿੱਚ ਹੀ ਕੀਤੇ ਜਾਂਦੇ ਹਨ